ਵੈਸੇ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਪਲ ਹਨ ਜਿਹਨਾਂ 'ਤੇ ਮੈਨੂੰ ਬਹੁਤ ਮਾਣ ਹੈ ਅਤੇ ਇੱਕ ਦਿਨ ਸਾਨੂੰ ਕਾਲਜ ਦੇ ਵਿੱਚ ਲੈਕਟਰ ਲਿਖਣ ਨੂੰ ਮਿਲਿਆ ਸੀ ਅਤੇ ਉਹ ਕੰਪੀਟੀਸ਼ਨ ਦੇ ਵਿੱਚ ਬੋਲਣਾ ਸੀ ਅਸੀਂ ਲੈਕਚਰ ਅਤੇ ਉਸ ਵਿੱਚ ਮੈਂ ਮਨੁੱਖ ਬਾਰੇ ਲਿਖਿਆ ਸੀ ਕਿ ਮਨੁੱਖ ਨੂੰ ਕਿਵੇਂ ਵਿਚਰਨਾ ਚਾਹੀਦਾ ਹੈ ਮਨੁੱਖ ਨੂੰ ਆਪਣੀ ਕਿਵੇਂ ਸਫ਼ਲਤਾ ਪ੍ਰਾਪਤ ਕਰਨੀ ਚਾਹੀਦੀ ਹੈ ਕਿਵੇਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਉਸ ਵਿੱਚ ਮੈਂ ਮਨੁੱਖ ਬਾਰੇ ਕਾਫ਼ੀ ਗੱਲਾਂ ਲਿਖ ਕੇ ਲੈ ਕੇ ਗਈ ਸੀ ਮਨੁੱਖ ਕਿਵੇਂ ਹੋਂਦ ਵਿੱਚ ਆਇਆ ਸੀ ਕਿਵੇਂ ਉਹਨਾਂ ਨੇ ਜਨਮ ਲਿਆ ਸੀ ਕਿਵੇਂ ਦੁਨੀਆ ਦੇ ਵਿੱਚ ਆਏ ਸੀ ਅਤੇ ਹ ਉਹ ਹਰ ਇੱਕ ਚੀਜ਼ ਮੈਂ ਲਿਖੀ ਸੀ ਅਤੇ ਆ ਮਨੁੱਖ ਨੂੰ ਆਪਣੇ ਆਪ ਨੂੰ ਕਿਵੇਂ ਮੋਟੀਵੇਸ਼ਨ ਰੱਖਣਾ ਚਾਹੀਦਾ ਹੈ ਇਹ ਚੀਜ਼ਾਂ ਵੀ ਮੈਂ ਕਾਫੀ ਲਿਖੀਆਂ ਸੀ ਅਤੇ ਜੋ ਲੈਕਚਰ ਉੱਥੇ ਕਾਫ਼ੀ ਪਸੰਦ ਆਏ ਸੀ ਅਤੇ ਜਦੋਂ ਉੱਥੇ ਮੈਨੂੰ ਮੈਨੂੰ ਇਨਾਮ ਮਿਲਿਆ ਸੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸੀ ਕਿਉਂਕਿ ਉੱਥੇ ਸਾਰਿਆਂ ਨੇ ਤਾੜੀਆਂ ਮਾਰੀਆਂ ਸੀ ਅਤੇ ਸਾਰਿਆਂ ਨੇ ਬਹੁਤ ਪ੍ਰਸ਼ੰਸਾ ਕੀਤੀ ਤੀ ਅਤੇ ਜਿਹੜੇ ਜੱਜਿਸ ਬੈਠੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਉਹ ਚੀਜ਼ ਅਤੇ ਮੈਨੂੰ ਉੱਥੇ ਬਹੁਤ ਮਾਣ ਹੋਇਆ ਸੀ